ਟੈਕਨੋਲੋਜੀ ਕਾਰਨ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਬਦਲਾਵ ਆਇਆ ਹੈ ਅਸੀਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਸਮਾਟਫੋਨ ਇੰਟਰਨੈੱਟ ਦੀ ਵਰਤੋਂ ਨਾਲ ਬਹੁਤ ਹੀ ਅਸਾਨ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਜਿਵੇਂ ਕਿ ਅਸੀਂ ਘਰ ਬੈਠੇ ਹੀ ਕਿਸੇ ਨਾਲ ਵੀ ਗੱਲ ਕਰ ਸਕਦੇ ਹਾਂ ਅਤੇ ਸਾਨੂੰ ਘਰ ਬੈਠੇ ਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਿਵੇਂ ਕਿ ਅਸੀਂ ਪਹਿਲਾਂ ਗੱਲ ਕਰਨ ਲਈ ਚਿੱਠੀਆਂ ਪਾਉਂਦੇ ਸੀ ਅਤੇ ਹੁਣ ਸਾਨੂੰ ਉਸਦੀ ਬਿਲਕੁਲ ਵੀ ਲੋੜ ਨਹੀਂ ਪੈਂਦੀ ਅਸੀਂ ਸਮਾਟਫੋਨ ਕਰਕੇ ਇੱਕ ਦੂਜੇ ਨਾਲ ਕਿਤੇ ਵੀ ਬੈਠ ਕੇ ਗੱਲ ਕਰ ਸਕਦੇ ਹਾਂ ਅਤੇ ਪਹਿਲਾਂ ਲੋਕ ਟਿਕਟਾਂ ਲੈਣ ਲਈ ਲੰਬੀ ਲੰਬੀ ਲਾਈਨਾਂ 'ਚ ਲੱਗਦੇ ਸੀ ਅਤੇ ਹੁਣ ਸਮਾਟਫੋਨ ਕਰਕੇ ਉਹੀ ਆਪਾਂ ਘਰ ਬੈਠੇ ਹੀ ਟਿੱਕਟ ਬੁੱਕ ਕਰਵਾ ਸਕਦੇ ਹਾਂ ਹੋਟਲ ਬੁੱਕ ਕਰਵਾ ਸਕਦੇ ਹਾਂ ਅਤੇ ਘਰ ਬੈਠੇ ਹੀ ਆਪਣਾ ਸਮਾਂ ਵੀ ਬਚਾ ਸਕਦੇ ਹਾਂ ਖਰੀਦਦਾਰੀ ਕਰ ਸਕਦੇ ਹਾਂ ਜਿਵੇਂ ਕਿ ਅਸੀਂ ਔਨਲਾਈਨ ਕੁਛ ਵੀ ਮੰਗਵਾ ਸਕਦੇ ਹਾਂ ਔਰ ਸਾਨੂੰ ਸਾਡੇ ਪੈਸਿਆਂ ਦੀ ਵੀ ਬੱਚਤ ਹੁੰਦੀ ਹੈ ਜਿੱਦਾਂ ਕਿ ਕੋਲੇਜ ਦੀ ਕਈ ਬੁੱਕਸ ਜੋ ਕਿ ਆਪਾਂ ਨਹੀਂ ਖਰੀਦ ਸਕਦੇ ਉਹੀ ਸਾਨੂੰ ਫ੍ਰੀ 'ਚ ਹੁਣ ਪੀ ਡੀ ਐਫ ਮਿਲ ਜਾਂਦਾ ਹੈ ਅਸੀਂ ਉਹੀ ਸਮੇਂ ਦੀ ਬੱਚਤ ਕਰ ਸਕਦੇ ਹਾਂ ਪੈਸੇ ਦੀ ਬੱਚਤ ਕਰ ਸਕਦੇ ਹਾਂ ਅਤੇ ਇੰਟਰਨੈੱਟ ਦੀ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਇਸ ਕਰਕੇ ਅਸੀਂ ਇਨ੍ਹਾਂ ਦੀ ਬਹੁਤ ਹੀ